ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵੀਰੇ ਸਾਈਜ਼ ਆਪਣਾ ਦੱਸ ਦਿਓ ਇੱਕ ਵਾਰੀ ਠੀਕ ਹੈ ਵੀਰੇ ਠੀਕ ਹੈ ਹੂੰ ਹੂੰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵੀਰੇ ਮੈਂ ਮੈਂ ਤੁਹਾਡੇ ਇਹ ਸਾਰਾ ਦੇਖ ਲਿਆ ਅਤੇ ਤੁਸੀਂ ਤੁਹਾਨੂੰ ਵੈਸੇ ਖੁਦ ਨੂੰ ਕਿੰਨਾ ਕਿਹੜਾ ਪਸੰਦ ਗਾ ਐਡੀਡਾਸ ਦਾ ਹੋ ਗਿਆ ਨਾਇਕੀ ਦਾ ਹੋ ਗਿਆ ਜਾਂ ਕੋਈ ਇਹੋ ਜਿਹੇ ਬਰੈਂਡ ਤੁਸੀਂ ਤੁਹਾਨੂੰ ਵਧੀਆ ਲੱਗਦੇ ਹੋਣ ਠੀਕ ਹੈ ਠੀਕ ਹੈ ਕਿਹਦੀ ਕਿਹਦੀ

ਕੋਈ ਨਾ ਵੀਰੇ ਆਪਣਾ ਥੋ ਤੁਸੀਂ ਕਿੰਨਾ ਸਾਈਜ਼ ਦੱਸਿਆ ਸੀ ਆਪਣਾ ਠੀਕ ਹੈ ਠੀਕ ਹੈ ਵੀਰੇ ਓਕੇ ਹਾਂਜੀ ਵੀਰੇ ਮੈਂ ਦੇਖਿਆ ਤੁਹਾਡਾ ਨਾਇਕੀ ਦਾ ਇੱਕ ਮੈਂ ਦੇਖੀ ਸੀਗੀ ਆਰਟ ਆਰਟੀਕਲ ਦੇਖਿਆ ਸੀਗਾ ਹੁੱਡੀ ਬੜੀ ਮਤਲਬ ਵਧੀਆ ਐੱਲ ਸਾਈਜ਼ ਤੁਹਾਡੇ ਪੂਰਾ ਫਿੱਟ ਆ ਜੂਗਾ ਕਲਰ ਉਹਦਾ ਵੀਰੇ ਹੈਗਾ ਓਰਿੰਜ ਰੰਗ ਦਾ ਵੀਰੇ ਹਾਂਜੀ ਹਾਂਜੀ ਮੈਂ ਸਮਝ ਗਿਆ ਉਹ ਤਾਂ ਮੈਂ ਤੁਹਾਨੂੰ ਇੱਕ ਰੈਂਡਮਲੀ ਕਲਰ ਦੱਸਿਆ ਤੁਸੀਂ ਕੋਈ ਨਾ ਆ ਜਾਓ ਸਾਡੇ ਸ਼ੋਪ 'ਤੇ ਤੁਹਾਨੂੰ ਦਿਖਾ ਦਾਂਗੇ ਕਿਹੜੀ ਵਰਾਇਟੀਆਂ ਨੇ ਸਾਡੇ ਕੋਲ ਹੋਰ ਹੁੱਡੀ ਤੋਂ ਇਲਾਵਾ ਹੋਰ ਸਾਡੇ ਕੋਲ ਟ੍ਰਾਊਜ਼ਰ ਆ ਟਰੈਕ ਸੂਟ ਨੇ ਅਤੇ ਜੇ ਤੁਸੀਂ ਫੋਰਮਲ ਦੇ ਵਿੱਚ ਜਾਂ ਚਾਰ ਬਰੈਂਡ ਵੀ ਨੇ ਸਾਡੇ ਕੋਲ ਜਿਵੇਂ ਕਹਿ ਲਓ ਨਾਇਕੀ ਦੇ ਐਡੀਡਾਸ ਹੋ ਗਿਆ ਫਿਰ ਵਿੱਚ ਪੂਮਾ ਦੀਆਂ ਹੁੱਡੀਆਂ ਵੀ ਆ ਗਈਆਂ ਅਤੇ ਵੀਰੇ ਰਿਬੂਕ ਆ ਗਿਆ ਇਕੱਲੇ ਸਾਡੇ ਕੋਲ ਸਪੋਰਟਸ ਦੀ ਆਈਟਿਮ ਆਈਟਮਸ ਨਹੀਂ ਗੀਆਂ ਅਲੱਗ ਸਾਡੇ ਕੋਲ ਫੋਰਮਲ ਲੁੱਕ ਲਈ ਵੀ ਹੈਗੀ ਹੈ ਜੇ ਤੁਸੀਂ ਕੋਈ ਚੂਸ ਕਰਨੀ ਹੈ ਤਾਂ ਆ ਸਕਦੇ ਹੋ ਸਾਡੀ ਸ਼ੋਪ 'ਤੇ

ਜ਼ੁਡੀਓ ਹਾਂਜੀ ਹਾਂਜੀ ਜ਼ੁਡੀਓ ਦੇ ਵੀ ਬੜੇ ਆਰਟੀਕਲਜ਼ ਆਉਂਦੇ ਸਾਡੇ ਕੋਲ ਹੋਰ ਵੀਰੇ ਹੋਰ ਜ਼ੁਡੀਓ ਤੋਂ ਇਲਾਵਾ ਹੁਣ ਜਿਵੇਂ ਕਿ ਇੱਕ ਅੱਧਾ ਕੱਲ੍ਹ ਪਰਸੋਂ ਹੀ ਆਇਆ ਸਾਡੇ ਕੋਲ ਨਵਾਂ ਮਾਲ ਹੈਗਾ ਸਾਡੇ ਕੋਲ ਅਰਟਿਕਲਸ ਤੁਸੀਂ ਆ ਕੇ ਇੱਕ ਵਾਰ ਵਿਜ਼ਿਟ ਤਾਂ ਕਰੋ ਤੁਹਾਨੂੰ ਸਾਰੇ ਦਿਖਾ ਦੇਵਾਂਗੇ ਹਾਂਜੀ ਹਾਂਜੀ ਕੁਛ ਵੀਰੇ ਕੁਛ ਸ਼ਿਪਮੈਂਟ ਬਾਹਰੋਂ ਵੀ ਹੁੰਦੀ ਹੈ ਕੁਛ ਅਸੀਂ ਇੱਧਰੋਂ ਬੌਂਬੇ ਤੋਂ ਮੰਗਾਉਂਦੇ ਹੁੰਦੇ ਹਾਂ ਸ਼ੋਰੂਮ ਹੈ ਵੀਰੇ ਸ਼ੋਰੂਮ ਹੈ ਸ਼ੋਰੂਮ ਹੈ ਵੀਰੇ ਇਹ ਆਪਣੇ ਆਉਂਦਾ ਮੋਡਲ ਟਾਊਨ ਨੀਅਰ ਆਪਣਾ ਇੱਕ ਮੋਡਲ ਟਾਊਨ ਫ੍ਰੈਂਚਾਇਸ ਹੈ ਇੱਕ ਜੀ ਐਨ ਈ ਦੇ ਲਾਗੇ ਆ ਉੱਥੇ ਤੁਸੀਂ ਆ ਸਕਦੇ ਹੋ ਨੀਅਰ ਟੂ ਜੀ ਐਨ ਈ ਮੋਲ ਰੋਡ ਤਿੰਨ ਸੌ ਬੱਤੀ ਗਲੀ ਨੰਬਰ ਰੋਡ ਰੋ ਹਾਂਜੀ ਹਾਂਜੀ ਵੀਰੇ ਤੁਸੀਂ ਜੀ ਐਨ ਈ ਆ ਜਾਓ ਸਾਡਾ ਨਾਲ ਹੀ ਦੁਕਾਨ ਗੀ ਸਾਡਾ ਮੁੰਡਾ ਆ ਜੂਗਾ ਨਾਲ ਤੁਹਾਡੇ ਦੱਸ ਦਿਓ ਤੁਸੀਂ ਇੱਕ ਵਾਰ ਕੋਲ ਕਰ ਲਿਓ ਸ਼ੋਪ 'ਚ ਹਾਂਜੀ ਵੀਰੇ ਮੇਰਾ ਨਾਮ ਮੇਰਾ ਨਾਮ ਜਸਕਰਨ ਹੈ ਅਤੇ ਨੰਬਰ ਮੇਰਾ ਨੋਟ ਕਰੋ ਤੁਸੀਂ ਏਟ ਟੂ ਸਿਕਸ ਫਾਈਵ ਏਟ ਥ੍ਰੀ ਟੂ ਵਨ ਵਨ ਜ਼ੀਰੋ ਹਾਂਜੀ ਵੀਰੇ ਓਕੇ